ਹਾਂਜੀ ਮੇਰੀ ਮਨਪਸੰਦ ਜਿਹੜੀ ਖੇਡ ਆ ਉਹ ਕ੍ਰਿਕਟ ਆ ਅਤੇ ਇਹਦੇ ਨਿਯਮਾਂ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਖੇਡਣ ਦੇ ਲਈ ਇੱਕ ਟੀਮ ਦੇ ਵਿੱਚ ਗਿਆਰ੍ਹਾਂ ਖਿਡਾਰੀ ਹੁੰਦੇ ਹਨ ਗਿਆਰ੍ਹਾਂ ਖਿਡਾਰੀਆਂ ਤੋਂ ਵੱਧ ਤੁਸੀਂ ਇਸ ਟੀਮ ਦੇ ਵਿੱਚ ਖਿਡਾਰੀਆਂ ਨੂੰ ਖਿਡਾ ਨਹੀਂ ਸਕਦੇ ਇੱਕ ਸਮੇਂ ਦੇ ਉੱਤੇ ਹਾਂ ਕੁਝ ਸ ਜਿਹੜੇ ਖਿਡਾਰੀ ਆ ਉਹ ਸਪੇਅਰ ਹੋ ਸਕਦੇ ਆ ਕਿ ਕਿਸੇ ਖਿਡਾਰੀ ਦੇ ਸੱਟ ਫ਼ੇਟ ਲੱਗਣ ਦੇ ਉੱਤੇ ਤੁਸੀਂ ਉਸ ਖਿਡਾਰੀ ਨੂੰ ਉਹਦੀ ਜਗ੍ਹਾ ਦੇ ਉੱਤੇ ਬਦਲ ਕੇ ਖਿਡਾ ਸਕਦੇ ਹਾਂ ਅਤੇ ਦੂਸਰਾ ਇਹ ਹੈ ਵੀ ਇਹਦੇ ਗਰਾਊਂਡ ਦੀ ਜਿਹੜੀ ਪੂਰੀ ਦਾ ਪੂਰਾ ਮੀਟਰ ਆ ਉਹ ਨਿਰਧਾਰਿਤ ਹੁੰਦਾ ਇਹ ਨਹੀਂ ਹੈ ਕਿ ਤੁਸੀਂ ਆਪਦੀ ਮਰਜ਼ੀ ਦੇ ਨਾਲ ਹੀ ਜਿੱਡਾ ਮਰਜ਼ੀ ਗਰਾਉਂਡ ਵੱਲ ਨੂੰ ਅਤੇ ਜਾਂ ਜਿਹੜੀ ਪਿੱਚ ਆ ਉਹਦੇ ਉੱਤੇ ਤੁਸੀਂ ਪਿੱਚ ਆਪਦੀ ਮਰਜ਼ੀ ਨਾਲ ਹੀ ਬਣਾ ਲਓ ਪਿੱਚ ਦਾ ਵੀ ਇੱਕ ਮੀਟਰ ਹੁੰਦਾ ਗਰਾਊਂਡ ਦਾ ਵੀ ਇੱਕ ਮੀਟਰ ਹੁੰਦਾ ਅਤੇ ਗਿਆਰ੍ਹਾਂ ਦੇ ਗਿਆਰ੍ਹਾਂ ਖਿਡਾਰੀਆਂ ਦੇ ਵਿੱਚ ਵੀ ਇਹ ਹੁੰਦਾ ਵੀ ਤੁਸੀਂ ਇੱਕ ਵਿਸ਼ੇਸ਼ ਢੰਗ ਦੇ ਨਾਲ ਇੱਕ ਸੂਚੀਬੱਧ ਤਰੀਕੇ ਦੇ ਨਾਲ ਉਹਦੇ ਵਿੱਚ ਬੈਟਿੰਗ ਅਤੇ ਬੋਲਿੰਗ ਦਾ ਆਰਡਰ ਆ ਜਿਹੜਾ ਉਹ ਰੱਖ ਸਕਦੇ ਹਾਂ ਰਣ ਰਣਨੀਤੀਆਂ ਦੀ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਵੱਖਰੇ ਵੱਖਰੇ ਸਮੇਂ ਦੇ ਉੱਤੇ ਵੱਖਰੀਆਂ ਵੱਖਰੀਆਂ ਰਣਨੀਤੀ ਜਿਹੜੀਆਂ ਖੇਡ ਦੇ ਵਿੱਚ ਵਰਤੀਆਂ ਜਾਂਦੀਆਂ ਧੰਨਵਾਦ